ਅਸੀਂ ਹੀ ਡਾਂਸ ਨੂੰ ਯਾਦਕਾਰ ਜਾਂ ਪ੍ਰਭਾਵਸ਼ਾਲੀ ਬਣਾਉਂਦੇ ਹਾਂ ਅਤੇ ਅਸੀਂ ਆਪਣੇ ਭਾਰਤ ਵਿੱਚ ਡਾਂਸ ਅਤੇ ਬੋਲੀਵੁੱਡ ਦਾ ਬਹੁਤ ਜ਼ਿਆਦਾ ਪ੍ਰਭਾਵ ਹਾਂ ਭਾਰਤ ਵਿੱਚ ਡਾਂਸਰ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਅਤੇ ਭਾਰਤ ਵਿੱਚ ਹੀ ਡਾਂਸਰ ਅਤੇ ਬੋਲੀਵੁੱਡ ਦਾ ਬਹੁਤ ਜ਼ਿਆਦਾ ਪ੍ਰਭਾਵ ਬੋਲੀਵੁੱਡ ਵਿੱਚ ਡਾਂਸਰ ਦੀ ਲੋੜ ਦੇ ਨਾਮ ਨਾਲ ਭਾਰਤ ਵਿੱਚ ਭੰਗੜਾ ਗਿੱਧਾ ਹਰ ਇੱਕ ਤਿਥ ਤਿਉਹਾਰ ਤਿਥ ਤਿਉਹਾਰ ਅਤੇ ਡਾਂਸਰ ਵੀ ਸ਼ਾਮਿਲ ਹੁੰਦੇ ਹਨ ਜੋ ਡਾਂਸਰ ਭਾਰਤ ਵਿੱਚ ਆਪਣਾ ਨਾਂ ਕਮਾ ਚੁੱਕੇ ਹਨ ਅਤੇ ਅਤੇ ਆਪ ਹਰ ਥਾਂ 'ਤੇ ਜਾ ਚੁੱਕੇ ਲੋਕ ਆਪਣਾ ਮਨੋਰੰਜਨ ਕਰਦੇ ਹਨ ਇਸ ਨਾਲ ਚੰਗੇ ਡਾਂਸਰ ਪੈਸੇ ਵੀ ਕਮਾਉਂਦੇ ਹਨ ਅਤੇ ਆਪਣਾ ਨਾਮ ਵੀ ਚੰਗੇ ਡਾਂਸਰ ਭਾਰਤ ਦੀਆਂ ਫਿਲਮਾਂ ਵਿੱਚ ਵੀ ਹਿੱਸਾ ਲੈਂਦੇ ਹਨ ਪੈਸੇ ਕਮਾਉਂਦੇ ਹਨ ਡਾਂਸਰ ਦੇ ਨਾਲ ਨਾਲ ਭਾਰਤ ਵਿੱਚ ਗੀਤਗਾਰ ਵੀ ਚੰਗੇ ਗੀਤ ਗਾ ਕੇ ਚੰਗੇ ਪੈਸੇ ਕਮਾਉਂਦੇ ਹਨ ਅਤੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਭਾਰਤ ਵਿੱਚ ਹਿੰਦੀ ਪੰਜਾਬੀ ਅਤੇ ਬਾਕੀ ਕਈ ਤਰ੍ਹਾਂ ਦੇ ਡਾਂਸ ਕੀਤੇ ਜਾਂਦੇ ਹਨ ਗੀਤ ਗਾਏ ਜਾਂਦੇ ਹਨ ਅਤੇ ਫਿਰ ਜਿਹੜੇ ਫੇਮਸ ਕਲਾਕਾਰ ਹੁੰਦੇ ਹਨ ਉਹ ਬਾਹਰ ਜਾ ਕੇ ਗੀਤ ਗਾਉਂਦੇ ਹਨ ਪੈਸੇ ਕਮਾਉਂਦੇ ਹਨ ਵਧੀਆ ਗੀਤਕਾਰ ਹਮੇਸ਼ਾ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ ਅਤੇ ਉਸਦੇ ਵਿਆਹ ਸ਼ਾਦੀ ਵਿੱਚ ਗੀਤ ਵਜਾਉਂਦੇ ਹਨ ਜਿਸ ਨਾਲ ਨੋਕ ਨੱਚਦੇ ਟੱਪਦੇ ਹਨ ਅਤੇ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਹਨ ਮਨੋਰੰਜਨ ਕਰਦੇ ਹਨ ਅਤੇ ਜਿਹੜੇ ਚੰਗੇ ਕਲਾਕਾਰ ਹੁੰਦੇ ਹਨ ਉਹ ਵਧੀਆ ਵਧੀਆ ਗੀਤ ਕੱਢਦੇ ਹਨ ਗੀਤ ਗਾਉਂਦੇ ਹਨ ਚੰਗੇ ਪੈਸੇ ਕਮਾਉਂਦੇ ਹਨ ਅਤੇ ਫਿਲਮਾਂ ਵਿੱਚ ਵੀ ਹਿੱਸਾ ਲੈਂਦੇ ਹਨ ਅਤੇ ਅਸੀਂ ਹੀ ਡਾਂਸ ਨੂੰ ਚੰਗੀ ਤਰ੍ਹਾਂ ਆਪਦਾ ਯਾਦ ਯਾਦਗਾਰ ਅਤੇ ਪ੍ਰਭਾਵਸ਼ਾਲੀ ਬਣਾਉਂਦੇ ਹਾਂ ਅਤੇ ਭਾਰਤ ਵਿੱਚ ਇਸ ਤਰ੍ਹਾਂ ਹੀ ਬਾਲੀਵੁੱਡ ਦਾ ਬਹੁਤ ਜ਼ਿਆਦਾ ਨਾਮ ਹੈ ਇਹਦੇ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈਗੀ ਕਿ ਕੋਈ ਸਾਨੂੰ